ਪੰਜਾਬ ਵਿੱਚ ਮਨੋਰੰਜਨ ਦੇ ਬਹੁਤ ਜ਼ਿਆਦਾ ਸਾਧਨ ਹਨ ਜਿਵੇਂ ਕਿ ਅਸੀਂ ਗੱਲ ਸ ਕਰ ਸਕਦੇ ਹਾਂ ਮੋਹਾਲੀ ਵਿੱਚ ਮੋਹਾਲੀ ਵਿੱਚ ਅਲੈਂਟਾ ਮੋਲ ਹੋ ਗਿਆ ਜਾਂ ਫਿਰ ਆਪਣਾ ਐਨ ਸੀ ਐਮ ਹੋ ਗਿਆ ਉਹ ਵੀ ਬਹੁਤ ਵਧੀਆ ਨੇ ਜਲੰਧਰ ਵਿੱਚ ਸਾਇੰਸ ਸਿਟੀ ਆ ਜਿੱਥੋਂ ਕਿ ਬੱਚਿਆਂ ਨੂੰ ਬਹੁਤ ਕੁਛ ਸਿੱਖਣ ਨੂੰ ਮਿਲਦਾ ਏ ਉੱਥੋਂ ਦੇ ਵੀ ਨੇ ਕਿ ਇੰਨੇ ਵਧੀਆ ਉੱਥੋਂ ਦੇ ਮੋਡਲਸ ਹੈ ਜੋ ਕਿ ਜਿਨ੍ਹਾਂ ਨੂੰ ਦੇਖ ਕੇ ਆਪਾਂ ਬਹੁਤ ਵਧੀਆ ਅੰਦਾਜ਼ਾ ਲਾ ਸਕਦੇ ਹਾਂ ਕਿੰਨੇ ਵਧੀਆ ਪਟਿਆਲਾ ਵਿੱਚ ਆਪਣੇ ਪੰਜਾਬ ਯੂਨੀਵਰਸਿਟੀ ਆ ਜਿੱਥੋਂ ਦਾ ਸਿੱਖਿਆ ਪੱਧਰ ਹੈ ਜੋ ਕਿ ਬਹੁਤ ਉੱਚਾ ਹੈ ਉੱਥੋਂ ਉੱਥੋਂ ਬਾਹਰ ਦੇ ਲੋਕ ਆਉਂਦੇ ਨੇ ਜਿਵੇਂ ਕਿ ਬਾਹਰ ਦੇ ਬੱਚੇ ਉੱਥੇ ਸਟੱਡੀ ਕਰਨ ਆਉਂਦੇ ਉਹਨਾਂ ਤੋਂ ਵੀ ਸਾਨੂੰ ਬਹੁਤ ਕੁਛ ਸਿੱਖਣ ਨੂੰ ਮਿਲਦਾ ਹੈ ਕਿ ਉਹ ਕਿਵੇਂ ਪੜ੍ਹਦੇ ਨੇ ਕਿਵੇਂ ਰਹਿੰਦੇ ਸਹਿੰਦੇ ਨੇ ਉਹਨਾਂ ਤੋਂ ਵੀ ਸਾਨੂੰ ਮਨੋਰੰਜਨ ਅਤੇ ਉਹਨਾਂ ਉਹਨਾਂ ਦੀਆਂ ਗੇਮਸ ਉਹਨਾਂ ਦੀਆਂ ਨੈਸ਼ਨਲ ਉਨ੍ਹਾਂ ਦੇ ਕੀ ਖੇਡਿਆ ਜਾਂਦਾ ਉੱਥੇ ਉਹ ਸਾਨੂੰ ਦੱਸਦੇ ਨੇ ਫਿਰ ਅਸੀਂ ਉਹਨਾਂ ਨਾਲ਼ ਹੋਰ ਆਪਣੀਆਂ ਗੇਮਸ ਉਹਨਾਂ ਨੂੰ ਦੱਸਦੇ ਨੇ ਉਹ ਸਾਨੂੰ ਦੱਸਦੇ ਨੇ ਇਸ ਨਾਲ਼ ਸਾਡਾ ਮਨੋਰੰਜ ਮਨੋਰੰਜਨ ਹੋ ਅਸੀਂ ਫ੍ਰੀ ਟਾਈਮ ਉਹਨਾਂ ਦੀਆਂ ਗੇਮਸ ਖੇਡ ਲੈਂਦੇ ਉਹ ਸਾਡੀਆਂ ਗੇਮਸ ਖੇਡ ਲੈਂਦੇ ਹਨ